ਵੀਹ ਜਨਵਰੀ ਦੋ ਹਜ਼ਾਰ ਤੇਰ੍ਹਾਂ ਦਸ ਅਗਸਤ ਦੋ ਹਜ਼ਾਰ ਪੰਦਰਾਂ ਤੀਹ ਜੂਨ ਦੋ ਹਜ਼ਾਰ ਸੋਲ੍ਹਾਂ ਵੀਹ ਜੂਨ ਉੱਨੀ ਸੌ ਸਤਾਨਵੇਂ ਬਾਰ੍ਹਾਂ ਜੁਲਾਈ ਦੋ ਹਜ਼ਾਰ ਇੱਕ